ਹੈਲੋ ਕੀ ਹਾਲ ਚਾਲ ਆ ਵੀਰੇ ਠੀਕ ਓਂ ਬਸ ਯਾਰ ਤੈਨੂੰ ਪਤਾ ਹੀ ਆ ਵੀ ਕੰਮਾਂ ਕਾਰਾਂ 'ਚ ਖੇਤੀਬਾੜੀ ਦਾ ਕ ਕੰਮ ਗਾਹ ਬਹੁਤਾ ਹੁੰਦਾ ਇਨਕਮ ਘੱਟ ਆ ਬਸ ਉਹ 'ਚ ਉਲਝੇ ਰਹਿੰਦੇ ਹਾਂ ਉਹੀ ਤਾਂ ਗੱਲ ਆ ਉਹਦਾ ਰੇਟ ਨਹੀਂ ਮਿਲਦਾ ਚੰਗੀ ਤਰ੍ਹਾਂ ਜੇ ਨਹੀਂ ਕਰਦੇ ਤਾਂ ਜ਼ਮੀਨ ਖਾਲੀ ਜਾਂਦੀ ਆ ਜੇ ਖਾਲੀ ਛੱਡਦੇ ਹਾਂ ਫਿਰ ਹੋਰ ਨੁਕਸਾਨ ਆ

ਉਹ ਤਾਂ ਉਹ ਤਾਂ ਹੈਗਾ ਜੇ ਸਰਕਾਰਾਂ ਚਾਹੁੰਣ ਜਿਵੇਂ ਹੁਣ ਇਹਨੇ ਸਰਕਾਰ ਨੇ ਕਿਹਾ ਤਾਂ ਮੈਂ ਮੂੰਗੀ ਅਤੇ ਉਹ ਦਊਗਾ ਐੱਮ ਐੱਸ ਪੀ ਦਊਗਾ ਜਾਂ ਹੋਰ ਦਊਗਾ ਜੇ ਇੱਦਾਂ ਕੁਛ ਹੋ ਜਾਵੇ ਨਾ ਬੰਦਾ ਇਹ ਕਿਸਾਨ ਆ ਜਿਵੇਂ ਆਪਾਂ ਲੋਕ ਕਿਸਾਨੀ ਕਰਦੇ ਹਾਂ ਆਪਾਂ ਬਦਲਵੀ ਫਸਲ 'ਤੇ ਆ ਜਾਂਗੇ ਅਤੇ ਜਿਹੜੇ ਇਹ ਆ ਜੀਰੀ ਦੇ ਵਿੱਚੋਂ ਬਾਹਰ ਨਿਕਲਾਂਗੇ ਨਾਲੇ ਪੰਜਾਬ ਦਾ ਪਾਣੀ ਬੱਚ ਜੂ ਉਹ ਸਬਜ਼ੀ ਵੀ ਕਿੰਨੀ ਕੁ ਲਾ ਲੂੰਗੇ ਸਬਜ਼ੀ ਤੁਸੀਂ ਹੋ ਹੁਣ ਕਿਸਾਨ ਆ ਕਿਸਾਨ ਦੀ ਸਬਜ਼ੀ ਕੀ ਕਰੂਗੀ ਤੁਸੀਂ ਆਪਣੀ ਘੀਆ ਦੋ ਰੁਪਈਆ ਉੱਥੇ ਜਾ ਕੇ ਪੰਜਾਹ ਰੁਪਏ ਵਿਕਦੀ ਆ ਤੁਹਾਨੂੰ ਕੀ ਮਿਲਦਾ ਕੁਝ ਵੀ ਨਹੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਤਾਂ ਹੈ ਜੀ ਉਹ ਤਾਂ ਉਹ ਤਾਂ ਹੁਣ ਕਰੇ ਰਹੇ ਹਾਂ ਪਰ ਹੁਣ ਇਨਕਮ ਘੱਟਦੀ ਜਾਂਦੀ ਆ ਕਰੀਏ ਕਿਆ ਹੁਣ ਇਨਕਮ ਦਾ ਕੋਈ ਵਧਾਉਣ ਦਾ ਕੋਈ ਸੌਰਸ ਹੋਣਾ ਚਾਹੀਦਾ ਨਾ ਓਕੇ ਉਵੇਂ ਦਾ ਤਾਂ ਹੱਲ ਕਰਨਾ ਪੈਣਾ ਸਰਕਾਰਾਂ ਸੁਣਦੀਆਂ ਨਹੀਂ ਆਪਾਂ ਨੂੰ ਕਿਸਾਨਾਂ ਨੂੰ ਰਲ ਮਿਲ ਕੇ ਕਰਨਾ ਪੈਣਾ ਇਹ ਫਸਲੀ ਚੱਕਰ ਦੇ ਵਿੱਚੋਂ ਨਿਕਲਣਾ ਪੈਣਾ ਕਿਸੇ ਤਰੀਕੇ ਨਾਲ ਅੱਛਾ ਅੱਛਾ ਚੱਲ ਮੈਨੂੰ ਨਾ ਫੋਨ ਆ ਰਿਹਾ ਵਿੱਚ ਨੂੰ ਮੇਰਾ ਮਿਲੀ ਮੈਨੂੰ ਘਰੇ ਆ ਕੇ ਗੱਲ ਕਰੀ ਯਾਰ ਠੀਕ ਆ ਵੀਰੇ ਜ਼ਰੂਰੀ ਆ